ਸਾਡੇ ਘਰ ਦੇ ਲੋਕ ਬਹੁਤ ਵਹਿਮ ਭਰਮ ਕਰਦੇ ਨੇ ਖ਼ਾਸ ਕਰਕੇ ਤਿਉਹਾਰਾਂ ਵਾਲੇ ਦਿਨਾਂ 'ਚ ਕਰਦੇ ਨੇ ਜਿਵੇਂ ਦੀਵਾਲੀ 'ਤੇ ਕਈ ਵਾਰ ਲੋਕ ਬਾਹਰ ਗਲੀਆਂ ਦੇ ਵਿੱਚ ਚੌਂਕਾਂ ਦੇ ਵਿੱਚ ਕੁਛ ਖਾਣ ਪੀਣ ਦਾ ਸਮਾਨ ਜਾਂ ਕੁਛ ਚੂੜੀਆਂ ਵਗੈਰਾ ਸਾਈਡ 'ਤੇ ਰੱਖ ਕੇ ਸਿੱਟ ਜਾਂਦੇ ਨੇ ਉੱਥੋਂ ਮਨਾ ਕਰਦੇ ਵੀ ਉੱਥੋਂ ਲੰਘਣਾ ਨਹੀਂ ਐਵੇਂ ਕੀ ਟੂਣਾ ਟੱਪਾ ਹੋ ਜਾਵੇਗਾ ਅਤੇ ਘਰ ਦੇ ਜਦੋਂ ਜਿਹੜੇ ਆਪਾਂ ਕੰਘੀ ਨਾਲ ਵਾਲ ਵਾਹੁੰਦੇ ਹਾਂ ਉਹ ਵੀ ਨਹੀਂ ਕਿਸੇ ਨੂੰ ਜਿਵੇਂ ਕੋਈ ਲੋਕ ਵੇਚ ਦਿੰਦੇ ਨੇ ਉੱਦਾਂ ਵੇਚਣ ਜਾਂ ਕਿਸੇ ਨੂੰ ਦੇਣ ਨਹੀਂ ਦਿੰਦੇ ਆਪਣੇ ਜਿਹੜੇ ਕੰਘੀ ਕੀਤੇ ਵਾਲ ਆ ਡਸਟਬਿਨ 'ਚ ਨਹੀਂ ਸਿੱਟਦੇ ਉਹ ਕਿਸੇ ਬੋਕਸ 'ਚ ਇਕੱਠੇ ਕਰਕੇ ਰੱਖ ਲੈਂਦੇ ਨੇ ਉਹਨੂੰ ਸਵਾਹ ਕਰ ਦਿੰਦੇ ਨੇ ਜਲ 'ਚ ਕਿ ਟੂਣਾ ਟੱਪਾ ਨਾ ਹੋ ਜਾਵੇ ਅਤੇ ਕਿਸੇ ਹੋਲੀ 'ਤੇ ਕਿਸੇ ਤੋਂ ਲੈ ਕੇ ਨਹੀਂ ਕੁਛ ਖਾਣਾ ਨਹੀਂ ਜਿਵੇਂ ਤਿਉਹਾਰ ਹੋਲੀ ਦਾ ਤਿਉਹਾਰ ਆ ਹੋਲੀ ਦੇ ਤਿਉਹਾਰ ਦੇ ਵਿੱਚ ਲੋਕ ਕੁਛ ਖਾਣ ਪੀਣ ਦੀਆਂ ਮਿੱਠੀਆਂ ਚੀਜ਼ਾਂ ਜਾਂ ਬਣਾ ਕੇ ਦਿੰਦੇ ਨੇ ਉਹ ਖਾਣ ਤੋਂ ਮਨਾ ਕਰਦੇ ਨੇ ਕਿਉਂਕਿ ਹੋਲੀ ਦੇ ਦਿਨਾਂ ਦੇ ਵਿੱਚ ਇਹ ਸਭ ਚੀਜ਼ਾਂ ਬਹੁਤ ਹੀ ਜਿਵੇਂ ਟੂਣਾ ਟੱਪਾ ਵਗੈਰਾ ਬਹੁਤ ਲੋਕ ਕਰਦੇ ਨੇ ਹੋਲੀ ਵਾਲੇ ਦਿਨਾਂ ਵਿੱਚ ਜ਼ਿਆਦਾ ਕੀਤੇ ਜਾਂਦੇ ਨੇ ਟੂਣੇ ਟੱਪੇ ਕਿਸੇ ਦਾ ਜੂਠਾ ਨਹੀਂ ਖਾਣ ਦਿੰਦੇ ਘਰ ਦੇ ਜੂਠਾ ਖਾਣ 'ਤੇ ਵੀ ਟੂਣੇ ਟੱਪੇ ਕੀ ਟੂਣੇ ਟੱਪੇ ਕਰ ਦਿੰਦੇ ਨੇ ਲੋਕ ਅਤੇ ਕਿਸੇ ਨੂੰ ਬਾਹਰ ਜੇ ਕੋਈ ਜਾ ਰਿਹਾ ਉਹਨੂੰ ਬਿਠਾ ਕੇ ਨਹੀਂ ਲੈ ਕੇ ਜਾਣਾ ਆਪਣੇ ਨਾਲ ਐਕਟਿਵਾ ਵਗੈਰਾ 'ਤੇ ਉੱਥੇ ਵੀ ਲੋਕ ਕਈ ਵਾਲ ਵਗੈਰਾ ਪੱਟ ਕੇ ਲੈ ਕੇ ਜਾ ਸਕਦੇ ਨੇ ਜਾਂ ਤੁਹਾਡੇ ਹੱਥ 'ਤੇ ਜਾਂ ਮੋਢੇ 'ਤੇ ਹੱਥ ਮਾਰ ਕੇ ਟੂਣਾ ਟੱਪਾ ਕਰ ਸਕਦੇ ਨੇ